ਹੈਲੋ ਤੁਸੀਂ ਸੁਣਾਓ ਵੀਰ ਜੀ ਵਧੀਆ ਹਾਂਜੀ ਹਾਂਜੀ ਸਹੀ ਗੱਲ ਹੈ ਵੀਰ ਜੀ ਉੱਨੀ ਸੌ ਛਪੰਜਾ ਇਹ ਬਾਦਲ ਹੋਣਾ ਜੀ ਸਰਕਾਰ ਵੇਲੇ ਆਈ ਸੀ ਬਹੁਤ ਵਧੀਆ ਜੀ ਮੈਂ ਕਿਹਾ ਬਹੁਤ ਵਧੀਆ ਸੀ ਉਹ ਤਾਂ ਕੰਮ

ਹਾਂਜੀ ਹਾਂਜੀ ਪਰ ਇਹ ਸਹੀ ਗੱਲ ਵੀਰੇ ਅਤੇ ਇਹਦਾ ਨੁਕਸਾਨ ਵੀ ਤਾਂ ਹੋਣ ਡਿਆ ਨਾ ਵੇਖੋ ਹੁਣ ਜਿਵੇਂ ਤੁਸੀਂ ਦੱਸਿਆ ਕਿ ਨਹਿਰਾਂ ਬਣਾਈਆਂ ਹੈ ਨਾ ਸਾਡੇ ਖੇਤਾਂ ਨੂੰ ਪਾਣੀ ਲੱਗਿਆ ਹਰੀ ਕ੍ਰਾਂਤੀ ਆਈ ਹੈ ਨਾ ਅਤੇ ਪਰ ਜਿਹੜਾ ਜਿਹੜੀਆਂ ਫੈਕਟਰੀਆਂ ਲੱਗ ਗਈਆਂ ਵੀਰੇ ਪਰ ਇਹਨਾਂ ਦਾ ਨੁਕਸਾਨ ਵੀ ਕਿੰਨਾ ਆ ਫੈਕਟਰੀਆਂ ਜਿੰਨਾ ਆਪਣਾ ਗੰਦਾ ਪ੍ਰਦੂਸ਼ਣ ਵਾਲਾ ਪਾਣੀ ਸਾਰਾ ਵਿੱਚ ਨਹਿਰਾਂ ਦੇ ਛੱਡ ਦਿੰਦੀਆਂ ਹੈ ਨਾ ਅਤੇ ਉਹ ਹੁਣ ਆਪਾਂ ਉਹ ਵੀ ਗੱਲ ਹੈ ਨਾ ਵੀਰ ਜੀ ਹੁਣ ਆਪਾਂ ਵੀ ਮਜਬੂਰ ਆ ਜਿਹੜਾ ਗਰੀਬ ਕਿਸਾਨ ਉਹ ਵਿਚਾਰਾ ਕੀ ਕਰੇ ਸਾਡੇ ਤੁਹਾਡੇ ਵਰਗੇ ਕਿਸਾਨ ਕੀ ਕਰਨਗੇ ਦੱਸੋ ਬੋਰਾਂ ਉੱਤੇ ਇੰਨਾ ਖਰਚਾ ਕਨੈਕਸ਼ਨ ਦਾ ਇੰਨਾ ਖਰਚਾ ਪੈ ਜਾਂਦਾ ਕੀ ਕਰ ਲਾਂਗੇ ਆਪਾਂ ਬਿਲਕੁਲ ਬਿਲਕੁਲ ਵੀਰ ਜੀ ਐਵੇਂ ਥੋੜ੍ਹੀ ਕਿਸਾਨ ਮਰਣਡਿਆ ਬਾਬੂ ਜੀ ਵੇਖੋ ਤੁਸੀਂ ਆਪ ਸਿਆਣੇ ਜੇ ਜਿਹੜੇ ਕਿਸਾਨ ਦੀ ਆਮਦਨੀ ਦਸ ਹਜ਼ਾਰ ਹੋਏਗੀ ਤਾਂ ਉਹਨੇ ਬਾਰਾਂ ਹਜ਼ਾਂਰ ਵਾਲਾ ਕਨੈਕਸ਼ਨ ਕਿੱਥੋਂ ਲਵਾ ਲੈਣਾ ਅਤੇ ਹੋਰ ਕੀ ਵੀਰ ਜੀ ਇਹੀ ਕੰਮ ਖ਼ਰਾਬ ਸਹੀ ਗੱਲ ਵੀਰ ਜੀ ਉਹੀ ਨਾ ਟਾਈਮ ਬਦਲਦਾ ਪਤਾ ਲੱਗਾ ਕਿਸੇ ਨੂੰ ਉੱਨੀ ਸੌ ਛਪੰਜਾ ਦੀ ਤਾਂ ਆਪਾਂ ਗੱਲ ਕਰਣਡੇ ਬਹੁਤ ਸਹੀ ਗੱਲ ਆ ਵੀਰ ਜੀ ਸਹੀ ਗੱਲ ਤੁਹਾਡੀ ਚਲੋ ਵੀਰ ਜੀ ਸਹੀ ਗੱਲ ਗਾਹ ਨੂੰ ਪੂਰਾ ਕਿੱਥੋਂ ਮਿਲੇ ਜੇਕਰ ਉਹ ਫ਼ਸਲ ਵਧੀਆ ਹੋਊ ਉਪਜਾਊ ਵਧੀਆ ਹੋਊ ਅਤੇ ਉਪਜਾਊ ਕਿੱਥੋਂ ਵਧੀਆ ਹੋਊ ਜਿੰਨੀ ਦੇਰ ਉਹਨੂੰ ਪਾਣੀ ਨਹੀਂ ਵਧੀਆ ਮਿਲਣਾ ਆਮ ਬੰਦੇ ਨੂੰ ਤਾਂ ਬਿਮਾਰੀਆਂ ਲੱਗਣੀਆਂ ਉਹੀ ਤਾਂ ਮੀਂਹਾਂ ਦਾ ਤਾਂ ਭਰੋਸਾ ਨਹੀਂ ਰਿਹਾ ਕਦੀ ਆਉਂਦਾ ਕਦੀ ਨਹੀਂ ਆਉਂਦਾ ਹਾਂਜੀ ਹਾਂਜੀ ਚਲੋ ਵਧੀਆ ਸੀ ਉਹ ਵੀ ਹਰੀ ਕ੍ਰਾਂਤੀ ਸਹੀ ਗੱਲ ਹੈ ਵੀਰ ਜੀ ਸਹੀ ਗੱਲ ਮੈਂ ਕਿਹਾ ਫਿਰ ਇੱਕ ਖੁਸ਼ਹਾਲ ਪੰਜਾਬ ਵੇਖਣ ਨੂੰ ਮਿਲ ਜੂ

ਹਾਂਜੀ ਹਾਂਜੀ ਠੀਕ ਹੈ ਵੀਰ ਜੀ ਫਿਰ